ਮੈਨੂੰ ਬਚਪਨ ਤੋਂ ਹੀ ਗੇਮਾਂ ਖੇਡਣ ਦਾ ਬਹੁਤ ਸ਼ੌਂਕ ਹੈ ਮੈਂ ਚਾਹੁੰਦਾ ਹਾਂ ਕਿ ਗੇਮ ਸੁਚਾਰੂ ਢੰਗ ਨਾਲ ਚੱਲਣ ਅਤੇ ਮੈਨੂੰ ਉੱਚ ਫਰੇਮ ਰੇਟ ਮਿਲੇ ਪਹਿਲਾਂ ਵੀ ਮੈਂ ਬਹੁਤ ਸਾਰੀਆਂ ਗੇਮਾਂ ਖੇਡ ਚੁੱਕਿਆ ਪ੍ਰੰਤੂ ਉਹਨਾਂ ਨੂੰ ਖੇਡ ਕੇ ਮੇਰੀ ਰੂਹ ਸੰਤੁਸ਼ਟ ਨਹੀਂ ਹੋਈ ਇਸ ਕਰਕੇ ਮੈਂ ਚਾਹੁੰਦਾ ਹਾਂ ਕਿ ਮੈਨੂੰ ਇੱਕ ਵਧੀਆ ਗ੍ਰਾਫਿਕਸ ਅਨੁਭਵ ਮਿਲੇ ਜੋ ਗੇਮਾਂ ਨੂੰ ਜੀਵਿਤ ਬਣਾਵੇ ਜਿਸ ਨਾਲ ਰਿਐਲਿਟੀ ਮੈਨੂੰ ਪੇਸ਼ ਹੋਵੇ ਇਦਾਂ ਲੱਗੇ ਕਿ ਮੈਂ ਅਸਲ ਵਿੱਚ ਇਹੀ ਜਿੰਦਗੀ ਜੀਅ ਰਿਹਾ ਹਾਂ ਮੇਰੇ ਅੱਖਾਂ ਦੇ ਇੱਕ ਵਧੀਆ ਵੀਆਰ ਪ੍ਰੋਜੈਕਟ ਲਗਾਇਆ ਜਾਵੇ ਜਿਸ ਨਾਲ ਮੈਂ ਇਸ ਸਕੀਮਾਂ ਦਾ ਵਧੀਆ ਅਨੁਭਵ ਕਰ ਸਕਾਂ ਕੀਮਤ ਘੱਟ ਤੋਂ ਘੱਟ ਹੋਵੇ ਮੈਂ ਇੱਕ ਅਜਿਹਾ ਕੰਸੋਲ ਚ ਆਉਂਦਾ ਹਾਂ ਜੋ ਮੇਰੇ ਬਜਟ ਦੇ ਅੰਦਰ ਹੋਵੇ ਅਤੇ ਮੈਨੂੰ ਉਸਦੀ ਕੀਮਤ ਦੇ ਬਰਾਬਰ ਪ੍ਰਦਰਸ਼ਨ ਵੀ ਦੇਵੇ ਜਿਵੇਂ ਕਿ ਗੇਮਿੰਗ ਕਨਸੋਲ ਕਈ ਤਰ੍ਹਾਂ ਦੇ ਹੁੰਦੇ ਹਨ ਹਨਾ ਖਾਸ ਕਨਸੋਲ ਮਾਡਲਾਂ ਦੇ ਨਾਮ ਜਿਵੇਂ ਕਿ ਪਲੇ ਸਟੇਸ਼ਨ ਫਾਈਵ ਐਕਸ ਬੋਕਸ ਸੀਰੀਜ਼ ਐਕਸ ਪਲੇਅ ਸਟੇਸ਼ਨ ਫਾਈਵ ਮੈ ਪਿਛਲੇ ਦੋ ਸਾਲਾਂ ਤੋਂ ਖੇਲ ਰਿਹਾ ਹਾਂ ਇਹ ਇੱਕ ਵਧੀਆ ਗੇਮ ਹੈ ਐਕਸ ਬੋਕਸ ਸੀਰੀਜ਼ ਵੀ ਮੈਂ ਪਿਛਲੇ ਦੋ ਚਾਰ ਸਾਲਾਂ ਤੋਂ ਖੇਲੀ ਹੈ ਇਹ ਵੀ ਮੈਨੂੰ ਬਹੁਤ ਵਧੀਆ ਲੱਗਦੀ ਹੈ ਇਸ ਸਟੇਸ਼ਨ ਦੇ ਵਿੱਚ ਬਹੁਤ ਸਾਰੀਆਂ ਗੇਮਾਂ ਹਨ ਜਿਵੇਂ ਡਬਲਿਊ ਡਬਲਿਊ ਈ ਹੈ ਹਨਾ ਹੋਰ ਵੀ ਰੇਸਿੰਗ ਦੀਆਂ ਕਈ ਗੇਮਾਂ ਹਨ ਜੋ ਕਿ ਵਿਜੂਅਲ ਰਿਸ ਡਿਸਪਲੇ ਕਰਦੀਆਂ ਰਿਐਲਿਟੀ 'ਚ ਪੇਸ਼ ਹੁੰਦੀਆਂ ਹਨ ਐਕਸ ਬੋਕਸ ਸੀਰੀਜ਼ ਵੀ ਕਈ ਵੋਰੀਅਰ ਗੇਮਸ ਹਨ ਜਿਵੇਂ ਕੰਡੀਸ਼ਨ ਜ਼ੀਰੋ ਨੀਡ ਫੋਰ ਸਪੀਡ ਹੈ ਹਨਾ ਕੋਂਟਸਟਾਈਕ ਐ ਆਈ ਜ਼ੀ ਆਈ ਐ ਸਾਰੀਆਂ ਗੇਮਾਂ ਬਹੁਤ ਵਧੀਆ ਹਨ ਪਰ ਮੁੱਖ ਤੌਰ ਤੇ ਮੈਨੂੰ ਡਬਲਿਊ ਡਬਲਿਊ ਚੈਪੀਅਨਸ਼ਿਪ ਗੇਮ ਖੇਡਣੀ ਬਹੁਤ ਪਸੰਦ ਹੈ ਇਸ ਵਿੱਚ ਥਰੀਡ ਵਿੱਚ ਹੋਰ ਗੇਮਸ ਆਪਣੇ ਤਜਰਬੇ ਅਤੇ ਰਾਏ ਸਾਂਝੇ ਕਰ ਸਕਦੇ ਹਨ ਜਿਵੇਂ ਤੁਸੀਂ ਹੋਰ ਸਵਾਲ ਵੀ ਜਿਵੇਂ ਕਿ ਕਨਸੋਲ ਖਾਸ ਗੇਮਾਂ ਲਈ ਬਿਹਤਰ ਹੈ ਕਿਹੜਾ ਕਨਸੋਲ ਵਧੀਆ ਆਨਲਾਈਨ ਮਲਟੀ ਪਲੇਅਰ ਅਨੁਭਵ ਪ੍ਰਦਾਨ ਕਰਦਾ ਹੈ ਮੈਨੂੰ ਉਹ ਕਨਸੋਲ ਚਾਹੀਦਾ ਜਿਹੜਾ ਆਨਲਾਈਨ ਵਧੀਆ ਮਲਟੀਪਲੈਕਸ ਅਨੁਭਵ ਕਰ ਕਰਾ ਸਕੇ ਮੈਨੂੰ ਮੇਰੀ ਗੇਮਾਂ ਖੇਲਣ ਦੀ ਜਿਹੜੀ ਰੁਚੀ ਆ ਇਸਨੂੰ ਹੋਰ ਵੀ ਵਧਾਉਣਾ ਚਾਹੁੰਦਾ ਹਾਂ ਈਵਨ ਕਿ ਮੈਂ ਬਾਅਦ ਵਿੱਚ ਗੇਮਿੰਗ ਡਿਜ਼ਾਇਨਿੰਗ ਵਿੱਚ ਵੀ ਜਾਣਾ ਚਾਹੁੰਦਾ ਹਾਂ ਪਰੰਤੂ ਮੈਨੂੰ ਜਿਵੇਂ ਦਾ ਮੈਂ ਚਾਹੁੰਦਾ ਹਾਂ ਉਵੇਂ ਦਾ ਕਨਸੋਲ ਨਹੀਂ ਮਿਲ ਰਿਹਾ ਜਿਸ ਕਰਕੇ ਮੈਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ